ਮੇਰੇ ਪਰਿਵਾਰ ਦੇ ਅੰਦਰ ਪਰਿਵਾਰਕ ਜੀਵਨ ਬਤੀਤ ਕਰਨ ਦੇ ਵਿੱਚ ਬਹੁਤ ਹੀ ਵੱਡਾ ਅਹਿਮ ਯੋਗਦਾਨ ਰਿਹਾ ਹੈ ਕਿਉਂਕਿ ਮੇਰੇ ਦਾਦਾ ਜੀ ਉਹਨਾਂ ਸਮਿਆਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਪੜ੍ਹਾਈ ਕੀਤੀ ਜਦੋਂ ਕਿ ਸਾਡੇ ਖੇਤਰ ਦੇ ਵਿੱਚ ਘੱਟ ਤੋਂ ਘੱਟ ਵੀਹ ਜਾਂ ਪੱਚੀ ਕਿਲੋਮੀਟਰ ਦੇ ਘੇਰੇ ਵਿੱਚ ਕੋਈ ਸਕੂਲ ਨਹੀਂ ਸੀ ਹੁੰਦਾ ਸ਼ਹਿਰ ਜਾਣ ਦੇ ਲਈ ਬਹੁਤ ਔਖਿਆਈ ਪੇਸ਼ ਆਉਂਦੀ ਸੀ ਤੁਰ ਕੇ ਉਹਨਾਂ ਨੂੰ ਜਾਣਾ ਪੈਂਦਾ ਸੀ ਪਰ ਉਹਨਾਂ ਨੇ ਪੜ੍ਹਾਈ ਦਾ ਲੈਵਲ ਆਪਣਾ ਉੱਚਾ ਰੱਖਿਆ ਉਸਦੇ ਨਾਲ਼ ਨਾਲ਼ ਮੇਰੇ ਪਰਿਵਾਰ ਨੂੰ ਅਤੇ ਹੋਰ ਅੱਗੇ ਪਰਿਵਾਰ ਨੂੰ ਉਹਨਾਂ ਨੇ ਪੜ੍ਹਾਈ ਦੇ ਬਾਰੇ 'ਚ ਦੱਸਿਆ ਜਾਣਕਾਰੀ ਦਿੱਤੀ ਜਿਸਦੇ ਨਾਲ਼ ਇਲਾਕੇ ਦੇ ਵਿੱਚ ਸਾਡੇ ਪਰਿਵਾਰ ਨੇ ਬਹੁਤ ਹੀ ਨਾਮਣਾ ਨਾਮ ਖੱਟਿਆ ਹੈ ਦੋਸਤਾਂ ਦੇ ਨਾਲ਼ ਰਲ਼ ਮਿਲਕੇ ਅਸੀਂ ਜੀਵਨ ਦਾ ਅਨੰਦ ਮਾਣਿਆ ਅਤੇ ਦੋਸਤਾਂ ਦੇ ਨਾਲ਼ ਰਲ ਮਿਲ ਕਰਕੇ ਅਸੀਂ ਚੰਗੀਆਂ ਗੱਲਾਂ ਸਿੱਖੀਆਂ